ਭਾਰਤ ਵਿਭਿੰਨਤਾ ਦਾ ਦੇਸ਼ ਹੈ ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਮੇਲੇ ਲੱਗਦੇ ਹਨ ਅਤੇ ਜਿਵੇਂ ਕਿ ਨਸ਼ਾ ਮੁਕਤ ਪਿੰਡਾਂ ਪਿੰਡਾਂ ਵਿੱਚ ਜਾ ਕੇ ਸ਼ਹਿਰ ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਨਸ਼ੇ ਦੇ ਵਿਰੁੱਧ ਬੱਚੇ ਨਸ਼ੇ ਵੱਲ ਜ਼ਿਆਦਾ ਤੁਰ ਰਹੇ ਹਨ ਸਰਕਾਰਾਂ ਵੀ ਬੜਾ ਉਪਰਾਲਾ ਕਰਦੀਆਂ ਹਨ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਪ੍ਰੇਰਨਾ ਦਿੱਤੀ ਜਾਵੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪਾਉਂਦਾ ਹੈ ਸਰਕਾਰ ਇਸ ਨੂੰ ਚੰਗੇ ਪਾਸੇ ਲਿਆਉਣ ਦੀ ਬੜੀ ਉਪਰਾਲਾ ਕਰ ਰਹੀ ਹੈ ਅਤੇ ਕੁਛ ਸਰਕਾਰ ਪੈਸਾ ਲਾ ਰਹੀ ਹੈ ਅਤੇ ਸੈਂਟਰ ਵੀ ਖੋਲ੍ਹੇ ਜਾਂਦੇ ਆ ਅਤੇ ਬੱਚਿਆਂ ਨੂੰ ਨਸ਼ੇ ਤੋਂ ਰਹਿਣ ਦੀ ਦੂਰ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਮੇਲੇ ਲੱਗਦੇ ਹਨ ਜਿਵੇਂ ਕਿ ਵਿਸਾਖੀ ਦਾ ਮੇਲਾ ਹੈਰੀਟੇਜ ਮੇਲਾ ਬੜਾ ਵਧੀਆ ਮੇਲੇ ਲੱਗਦੇ ਹਨ ਅਤੇ ਇਸ ਵਿੱਚ ਮੈਂ ਵੀ ਜਾਂਦੀ ਹਾਂ ਅਤੇ ਮੈਨੂੰ ਬੜਾ ਵਧੀਆ ਲੱਗਦਾ ਬੜਾ ਮੰਨੋਰੰਜਨ ਹੁੰਦਾ ਹੈ